ਸਤਿ ਸ਼੍ਰੀ ਅਕਾਲ ਜੀ ਜੇਕਰ ਮੈਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਆਪਣੀਆਂ ਗੱਲਾਂ ਨੂੰ ਸਾਂਝੀਆਂ ਕਰਨੀਆਂ ਚਾਹਾਂ ਜਾਂ ਫੇਰ ਉਹਨਾਂ ਦੇ ਨਾਲ ਮੈਂ ਕੁਝ ਸਮਾਂ ਬਿਤਾਉਣਾ ਚਾਹਾਂ ਤਾਂ ਮੈਂ ਉਹਨਾਂ ਨੂੰ ਆਪਣੀ ਰਸੋਈ ਦੇ ਕੰਮਾਂ ਵਿੱਚ ਮਦਦ ਕਰਨ ਦੇ ਲਈ ਆਖਾਂਗੀ ਇਹ ਮਦਦ ਕਈ ਤਰ੍ਹਾਂ ਨਾਲ ਹੋ ਜਾਂਦੀ ਹੈ ਜਿਵੇਂ ਕਿ ਅਗਰ ਮਟਰ ਛਿੱਲਣੇ ਹਨ ਤਾਂ ਮੈਂ ਉਹਨਾਂ ਨੂੰ ਨਾਲ ਆਪਣੀ ਹੈਲਪ ਕਰਨ ਦੇ ਲਈ ਆਖ ਦੇਵਾਂਗੀ ਕਿਉਂਕਿ ਮਟਰ ਛਿੱਲਣ ਵਾਸਤੇ ਥੋੜ੍ਹਾ ਟਾਈਮ ਲੱਗਦਾ ਹੈ ਇਸਦੇ ਨਾਲ ਗੱਲਾਂ ਵੀ ਸਾਂਝੀਆਂ ਹੋ ਜਾਣਗੀਆਂ ਅਤੇ ਸਾਡਾ ਕੰਮ ਵੀ ਹੋ ਜਾਵੇਗਾ ਜੇਕਰ ਮੈਂ ਪਕੌੜੇ ਤਲ ਰਹੀ ਹਾਂ ਤਾਂ ਮੈਂ ਉਹਨਾਂ ਨੂੰ ਆਖ ਦੇਵਾਂਗੀ ਕਿ ਤੁਸੀਂ ਨਾਲ ਚਾਹ ਵੀ ਬਣਾ ਲਓ ਇਸ ਦੇ ਨਾਲ ਵੀ ਅਸੀਂ ਇੱਕ ਦੂਸਰੇ ਦੇ ਨਾਲ ਗੱਲਾਂ ਸਾਂਝੀਆਂ ਕਰ ਲਵਾਂਗੇ ਅਤੇ ਨਾਲ ਦੀ ਨਾਲ ਕੰਮ ਵੀ ਕਰਦੇ ਰਹਾਂਗੇ ਇਕੱਠੇ ਕੰਮ ਕਰਨ ਦੇ ਨਾਲ ਵੀ ਚੀਜ਼ ਦਾ ਸਵਾਦ ਦੁੱਗਣਾ ਆਉਂਦਾ ਹੈ ਧੰਨਵਾਦ ਜੀ